ਅੱਜ ਦੇ ਸਮੇਂ ਵਿੱਚ ਟੈਕਨੋਲਜੀ ਇੰਨੀ ਵੱਧ ਗਈ ਹੈ ਕਿ ਘਰ ਬੈਠੇ ਹੀ ਸਭ ਕੁਝ ਸਿੱਖ ਸਕਦੇ ਹਾਂ ਅਤੇ ਸਭ ਨੂੰ ਸਿਖਾ ਸਕਦੇ ਹਾਂ ਅਤੇ ਆਨਲਾਈਨ ਕਲਾਸਾਂ ਦੇ ਸਕਦੇ ਹਾਂ ਅਤੇ ਲੈ ਸਕਦੇ ਹਾਂ ਲੋਕਡਾਊਨ ਤੋਂ ਬਾਅਦ ਟੈਕਨੋਲਜੀ ਦਾ ਹੋਰ ਵੀ ਵੱਧ ਇਸਤੇਮਾਲ ਹੋਣ ਲੱਗ ਪਿਆ ਹੈ ਅਤੇ ਅਸੀਂ ਘਰ ਬੈਠੇ ਹੀ ਸਭ ਕੁਝ ਮੰਗਵਾ ਸਕਦੇ ਹਾਂ ਜਿਵੇਂ ਕਿ ਪਹਿਨਣ ਨੂੰ ਅਤੇ ਘਰ ਦੇ ਇਸਤੇਮਾਲ ਨੂੰ ਬਹੁਤ ਕੁਝ ਮੰਗਵਾ ਸਕਦੇ ਹਾਂ ਅਗਰ ਸਾਨੂੰ ਕੋਈ ਵੀ ਸਮਾਨ ਪਸੰਦ ਨਹੀਂ ਆਉਂਦਾ ਤਾਂ ਅਸੀਂ ਵਾਪਸ ਵੀ ਕਰ ਸਕਦੇ ਹਾਂ ਇਸ ਦੇ ਫ਼ਾਇਦੇ ਵੀ ਬਹੁਤ ਹਨ ਜਿਵੇਂ ਕਿ ਘਰ ਵਿੱਚ ਅਸੀਂ ਇਕੱਲੇ ਹਾਂ ਅਤੇ ਘਰ ਵਿੱਚ ਰਿਸ਼ਤੇਦਾਰ ਆ ਜਾਣ ਤਾਂ ਘਰ ਬੈਠੇ ਹੀ ਸਮਮਾਂ ਸਮਾਨ ਮੰਗਵਾ ਸਕਦੇ ਹਾਂ ਅਤੇ ਇਸ ਦੇ ਨੁਕਸਾਨ ਵੀ ਹਨ ਜਿਵੇਂ ਕਿ ਬੱਚੇ ਘਰ ਬੈਠ ਬੈਠ ਕੇ ਆਲਸੀ ਹੋ ਗਏ ਹਨ ਕੋਈ ਵੀ ਸਮਾਨ ਲਿਆਉਣ ਲਈ ਕਹੀਏ ਤਾਂ ਝੱਟ ਔਨਲਾਈਨ ਓਡਰ ਕਰ ਕੇ ਮੰਗਵਾ ਦਿੰਦੇ ਹਨ ਪਰ ਘੁੰਮ ਫਿਰ ਕੇ ਚੀਜ਼ ਲਿਆਉਣਾ ਪਸੰਦ ਨਹੀਂ ਕਰਦੇ ਘੁੰਮ ਫਿਰ ਕੇ ਚੀਜ਼ ਲਿਆਉਣ ਨਾਲ ਤਾਂ ਕਿ ਸਰੀਰ ਨੂੰ ਵੀ ਫ਼ਾਇਦਾ ਮਿਲਦਾ ਹੈ